ਮੈਂ ਹਾਂ ਮਾਨਸਿਕ ਸਿਹਤ ਸਮੱਸਿਆ ਲਈ ਜਾਣਦੀ ਹਾਂ ਮਾਨਸਿਕ ਸਿਹਤ ਸਮੱਸਿਆ ਲਈ ਟੈਂਸ਼ਨ ਅਤੇ ਡਿਪਰੈਸ਼ਰ ਦੇ ਜ਼ਿਆਦਾ ਹੁੰਦੀ ਹੈ ਅੱਜਕੱਲ੍ਹ ਲੋਕਾਂ ਵਿੱਚ ਬਹੁਤ ਪਾਈ ਜਾਂਦੀ ਹੈ ਲੋਕਾਂ ਨ ਨਹੀਂ ਲੁਕਾਉਂਦੇ ਨੇ ਡਾਕਟਰ ਕੇ ਪਾਸ ਜਾ ਕੇ ਦੱਸਦੇ ਨੇ ਕਿ ਸਾਨੂੰ ਇਹ ਸਮੱਸਿਆ ਹੈ ਸਾਡੇ ਰੋਪੜ ਵਿੱਚ ਹੋਸਪੀਟਲ ਬਵੇਜਾ ਹੋਸਪੀਟਲ ਬਹੁਤ ਵਧੀਆ ਹੋਸਪੀਟਲ ਹੈ ਦਿਮਾਗ਼ ਦਾ ਬਹੁਤ ਜ਼ਿਆਦਾ ਅੱਛਾ ਡਾਕਟਰ ਹੈ ਅਤੇ ਲੋਕ ਉਹਨਾਂ ਕੋਲ ਜਾਂਦੇ ਵੀ ਹੈ ਕਾਫ਼ੀ ਨੇੜੇ ਤੇੜੇ ਦੇ ਲੋਕ ਵੀ ਉਹਨਾਂ ਕੋਲ ਜਾ ਕੇ ਇਲਾਜ ਕਰਵਾਉਂਦੇ ਹੈ ਬਹੁਤ ਅੱਛਾ ਇਲਾਜ ਕਰਦਾ ਹੈ ਉਹ ਡਾਕਟਰ